ਫੋਟੋਗ੍ਰਾਫੀ ਦੇ ਵਿੱਚ ਜੇ ਆਪਾਂ ਪੁਰਾਣੇ ਸਾਲਾਂ ਦੇ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਹੁਣ ਕਾਫੀ ਸਾਰਾ ਚੇਂਜ ਆ ਚੁੱਕਿਆ ਹੈ ਕਿਉਂਕਿ ਹੁਣ ਜੋ ਵੀ ਟੈਕਨੋਲੋਜੀ ਦੇ ਨਾਲ ਕੈਮਰਿਆਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਚੁੱਕਿਆ ਜਿੱਦਾਂ ਕਿ ਆਪਾਂ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਸਿਰਫ ਫੋਟੋ ਖਿੱਚਣ ਦੇ ਲਈ ਆਪਾਂ ਇੱਕ ਕੈਮਰੇ ਦਾ ਯੂਸ ਕਰਦੇ ਸੀਗੇ ਅਤੇ ਉਹ ਕੈਮਰਾ ਵੀ ਹਰ ਕਿਸੇ ਦੇ ਕੋਲ ਨਹੀਂ ਸੀ ਹੁੰਦਾ ਅਤੇ ਉਹ ਕੈਮਰੇ ਨੂੰ ਹਰ ਕੋਈ ਚਲਾ ਨਹੀਂ ਸੀ ਸਕਦਾ ਹੁੰਦਾ ਕਿਉਂਕਿ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਪਹਿਲਾਂ ਦੇ ਕੈਮਰਿਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਸੀਗੀਆਂ ਰੀਲਾਂ ਬਣਦੀਆਂ ਹੁੰਦੀਆਂ ਸੀਗੀਆਂ ਅਤੇ ਉਹ ਰੀਲ ਨੂੰ ਫਿਰ ਧਵਾਉਣਾ ਪੈਂਦਾ ਹੁੰਦਾ ਸੀਗਾ ਜਿਹੜੀ ਉਹ ਚੀਜ਼ ਆ ਉਹ ਕਾਫੀ ਜ਼ਾਰਾ ਜ਼ਿਆਦਾ ਇੱਕ ਟਾਈਮ ਵੀ ਲਗਾਉਂਦੀ ਸੀਗੀ ਕਾਫੀ ਜ਼ਿਆਦਾ ਵੇਟ ਵੀ ਕਰਨੀ ਪੈਂਦੀ ਸੀਗੀ ਤੁਹਾਨੂੰ ਇੱਕ ਫੋਟੋ ਖਿਚਵਾਉਣ ਦੇ ਲਈ ਅਤੇ ਜੇ ਉਹ ਤੋਂ ਪਹਿਲਾਂ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਬਲੈਕ ਐਂਡ ਵਾਈਟ ਫੋਟੋਜ਼ ਹੀ ਆਉਂਦੀਆਂ ਸੀ ਬਟ ਜਿਵੇਂ ਜਿਵੇਂ ਹੁਣ ਟੈਕਨੋਲੋਜੀ ਦਾ ਡਿਵੈਲਪਮੈਂਟ ਹੋਈ ਆ ਹੁਣ ਜਿਹੜੀ ਆਪਾਂ ਫੋਟੋਜ਼ ਆ ਉਹ ਆਪਾਂ ਆਪਣੇ ਫੋਨਾਂ ਦੇ ਵਿੱਚ ਖਿੱਚਦੇ ਹਾਂ ਅੱਜ ਕੱਲ੍ਹ ਦੇ ਫੋਨਾਂ ਦੇ ਕੈਮਰੇ ਨੇ ਜ਼ਿਆਦਾ ਵਧੀਆ ਨੇ ਕਿ ਉੱਥੇ ਆਪਾਂ ਨੂੰ ਇਹ ਚੀਜ਼ ਨਹੀਂ ਦੇਖਣੀ ਪੈਂਦੀ ਕਿ ਲਾਈਟ ਦਾ ਇਫੈਕਟ ਕਿਵੇਂ ਦਾ ਆਊਗਾ ਮਤਲਬ ਫੋਟੋ ਦੀ ਪੁਰਾਣੇ ਸਮਿਆਂ ਦੇ ਕੰਪੈਰੀਜ਼ਨ ਜੇ ਆਪਾਂ ਕਰਕੇ ਦੇਖੀਏ ਤਾਂ ਹੁਣ ਕਾਫੀ ਜ਼ਿਆਦਾ ਕਲੈਰਿਟੀ ਹੈ ਅਤੇ ਆਪਾਂ ਨੂੰ ਫੋਟੋ ਖਿੱਚਣੀ ਬਹੁਤ ਜ਼ਿਆਦਾ ਸੌਖੀ ਹੈ ਅਤੇ ਇੰਨਾ ਟਾਈਮ ਵੇਟ ਨਹੀਂ ਕਰਨਾ ਪੈਂਦਾ ਆਪਣੀ ਫੋਟੋ ਦੇ ਲਈ ਜਿਹੜੀ ਆਪਾਂ ਪਹਿਲਾਂ ਖਿਚਵਾਈ ਸੀ ਅਤੇ ਸੋ ਓਵਰਆਲ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਫੋਟੋਗ੍ਰਾਫੀ ਦੇ ਵਿੱਚ ਹੈਲਪਫੁਲ ਰਹੀ ਹੈ